ਹਾਂਜੀ ਸਤਿ ਸ਼੍ਰੀ ਅਕਾਲ ਜੀ ਅ ਰਵੀਨਾ ਬੋਲ ਰਹੇ ਹੋ ਮੈਂ ਤੁਹਾਡੀ ਸੁਸਾਈਟੀ ਵਿੱਚ ਜਿਹੜੀ ਨਵੀਂ ਆਈ ਹਾਂ ਨਾ ਅ ਪ੍ਰੀਤੀ ਉਹ ਬੋਲਦੀ ਪਈ ਹਾਂ ਹਾਂਜੀ ਹਾਂਜੀ ਮੈਂ ਹਾਂਜੀ ਮੈਂ ਤੁਹਾਨੂੰ ਵੇਖਿਆ ਤਾਂ ਸੀ ਕੱਲ੍ਹ ਸੋਸਾਇਟੀ ਦੀ ਮੀਟਿੰਗ 'ਚ ਬਟ ਮੈਂ ਤੁਹਾਡੇ ਕੋਲ ਪਹੁੰਚ ਨਹੀਂ ਪਾਈ ਹਾਂਜੀ ਅ ਮੈਂ ਮੈਂ ਨਾ ਸੁਸਾਈਟੀ ਦੇ ਸੈਕਰੇਟਰੀ ਤੋਂ ਤੁਹਾਡਾ ਨੰਬਰ ਲਿੱਤਾ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਨਵੀਂ ਆਈ ਹਾਂ ਅਤੇ ਮੈਨੂੰ ਫਰੀਦਕੋਟ ਬਾਰੇ ਇੰਨੀ ਨੌਲੇਜ ਨਹੀਂ ਹੈਗੀ ਤਾਂ ਮੈਂ ਨਾ ਤੁਹਾਨੂੰ ਇਹ ਪੁੱਛਣਾ ਸੀ ਕਿ ਇੱਥੇ ਤਾਜ਼ਾ ਸਬਜ਼ੀ ਕਿੱਥੇ ਮਿਲਦੀ ਹੈ ਹਾਂਜੀ ਹਾਂਜੀ ਓਕੇ ਓਕੇ ਮੁਝੇ ਮੇਰੇ ਪੇਰੈਂਟਸ ਹੈ ਨਾ ਉਹ ਨਿਊਟਰਲਿਸਟ ਆ ਤਾਂ ਫਿਰ ਉਹ ਅਸੀਂ ਜਦੋਂ ਪਹਿਲਾਂ ਪੱਕੇ ਪਿੰਡ ਰਹਿੰਦੇ ਸੀ ਉੱਥੇ ਤਾਂ ਅਸੀਂ ਖੇਤ ਤੋਂ ਹੀ ਲੈਂਦੇ ਸੀ ਹੁਣ ਇੱਥੇ ਤਾਂ ਸਾਨੂੰ ਪਤਾ ਨਹੀਂ ਕਿੱਥੇ ਮਿਲਣਗੀਆਂ ਹਾਂਜੀ ਹਾਂਜੀ ਫਿਰ ਇਹ ਕਿੱਥੇ ਆ ਮੰਡੀ ਹਾਂਜੀ ਕੋਈ ਨਾ ਤੁਸੀਂ ਜਦੋਂ ਜਾਣਾ ਹੋਏ ਉਦੋਂ ਮੈਨੂੰ ਦੱਸ ਦਿਓ ਮੈਂ ਉਦੋਂ ਹੀ ਆ ਜਾਂਗੀ ਨਹੀਂ ਹਰੀਆਂ ਹੀ ਜ਼ਿਆਦਾ ਪਸੰਦ ਕਰਦੇ ਹਾਂ ਅੱਛਾ ਅੱਛਾ ਹਾਂਜੀ ਹਮ ਹਰੀਆਂ ਹਾਂਜੀ ਆਹ ਹਰੀਆਂ ਸਬਜ਼ੀਆਂ ਦੇ ਤਾਂ ਫਾਇਦੇ ਹੀ ਬਹੁਤ ਆ ਹਾਂਜੀ ਹਾਂਜੀ ਉਹ ਤਾਂ ਹੈ ਹੀ ਹਾਂਜੀ ਠੀਕ ਹੈ ਕੋਈ ਨਾ ਤੁਸੀਂ ਮੈਨੂੰ ਦੱਸ ਦਿਓ ਜਦੋਂ ਜਾਣਾ ਹੋਇਆ ਠੀਕ ਹੈ ਓਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ